ਹਾਂ ਮੈਨੂੰ ਲੱਗਦਾ ਹੈ ਕਿ ਅੱਜ ਕੱਲ੍ਹ ਟੀ ਵੀ ਅਤੇ ਔਨਲਾਈਨ 'ਤੇ ਖੇਤਰੀ ਭਾਸ਼ਾਵਾਂ ਵਿੱਚ ਵਧੇਰੇ ਵਿੱਦਿਅਕ ਸਮੱਗਰੀ ਬਣਾਉਣੀ ਚਾਹੀਦੀ ਹੈ ਅਤੇ ਬੱਚਿਆਂ ਦੇ ਬਿਹਤਰ ਵਿਕਾਸ ਲਈ ਸਮੱਗਰੀ ਵੀ ਬਣਾਉਣੀ ਚਾਹੀਦੀ ਹੈ ਕਿਉਂਕਿ ਅੱਜ ਕੱਲ੍ਹ ਐਸਾ ਸਮਾਂ ਆ ਗਿਆ ਹੈ ਕਿ ਬੱਚੇ ਜ਼ਿਆਦਾਤਰ ਜ਼ਿਆਦਾਤਰ ਔਨਲਾਈਨ ਜਾਂ ਫਿਰ ਟੀ ਵੀ ਨੂੰ ਮਹਾਨਤਾਨ ਦਿੰਦੇ ਹਨ ਅੱਜ ਕੱਲ੍ਹ ਜੋ ਉਹ ਸਿ ਦਿਖ ਦੇਖਦੇ ਹਨ ਉਹੀ ਸਿੱਖਦੇ ਹਨ ਇਸ ਕਰਕੇ ਟੀ ਵੀ ਵਿੱਚ ਐਸੇ ਪ੍ਰੋਗਰਾਮ ਆਉਣੇ ਚਾਹੀਦੇ ਹਨ ਜੋ ਕਿ ਬੱਚਿਆਂ ਦੇ ਵਿਕਾਸ ਨੂੰ ਵਧਾਉਣ ਲਈ ਮਦਦ ਕਰਨ ਅਤੇ ਉਹਨਾਂ ਦੇ ਅਨੁਭਵ ਨੂੰ ਵੀ ਵਧਾਉਣ ਅਤੇ ਔਨਲਾਈਨ 'ਚ ਕਈ ਐਸੇ ਪਲੈਟਫੋਰਮ ਹਨ ਜਿਵੇਂ ਕਿ ਯੂਟੀਊਬ ਜਿਸ ਜਿਸ ਵਿੱਚ ਬੱਚਿਆਂ ਦੇ ਪੜ੍ਹਨ ਦੇ ਸਬੰਧੀ ਕਈ ਐਸੇ ਵੀਡੀਓਜ਼ ਆਉਂਦੀਆਂ ਹਨ ਜੋ ਕਿ ਬੱਚੇ ਦੇਖਦੇ ਹਨ ਅਤੇ ਉਸ ਦੇ ਅਤੇ ਉਹਨੂੰ ਪੜ੍ਹ ਪੜ੍ਹ ਉਸ ਨੂੰ ਸਮਝ ਕੇ ਪੜ੍ਹਦੇ ਹਨ ਜਜ਼ਬਾ ਜ਼ਿਆਦਾਤਰ ਅੱਜ ਕੱਲ੍ਹ ਬੱਚੇ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ ਅਤੇ ਸੋਚਦੇ ਹਨ ਕਿ ਇਹ ਬਿਹਤਰ ਤਰੀਕਾ ਹੈ ਅੱਜ ਕੱਲ੍ਹ ਤਾਂ ਬੱਚਾ ਜਦੋਂ ਛੋਟਾ ਹੁੰਦਾ ਹੈ ਉਦੋਂ ਹੀ ਟੀ ਵੀ ਜਾਂ ਔਨਲਾਈਨ ਔਨਲਾਈਨ ਯੂਟਿਊਬ 'ਤੇ ਦੇਖ ਚੀਜ਼ਾਂ ਦੇਖਣਾ ਸ਼ੁਰੂ ਕਰ ਦਿੰਦਾ ਹੈ ਬੱਚੇ ਜਿੰਨਾ ਦੇਖਣਗੇ ਉੱਨਾ ਸਮਝਣਗੇ ਜਿਵੇਂ ਕਿ ਇੱਕ ਇਗਜ਼ਾਮਪਲ ਲੈ ਲਈਏ ਜਦੋਂ ਛ ਬੱਚਾ ਛੋਟਾ ਹੁੰਦਾ ਹੈ ਤਾਂ ਉਸਦਾ ਦਿਮਾਗ ਜ਼ਿਆਦਾ ਤੇਜ਼ ਹੁੰਦਾ ਹੈ ਅਤੇ ਅਸੀਂ ਉਸਨੂੰ ਜੋ ਦੱਸਾਂਗੇ ਉਹ ਉਹੀ ਦੇਖੇਗਾ ਅਤੇ ਉਹੀ ਉਹ ਕਰੇਗਾ ਜੇ ਬੱਚੇ ਨੂੰ ਅਸੀਂ ਸ਼ੁਰੂ ਤੋਂ ਹੀ ਪੜ੍ਹਨ ਵੱਲ ਲਗਾਈਏ ਤਾਂ ਉਸਦਾ ਦਿਮਾਗ ਤੇਜ਼ ਹੋਵੇਗਾ ਅਤੇ ਉਹ ਅੱਗੇ ਜਾ ਕੇ ਸਮਝਦਾਰ ਅਤੇ ਹੁਸ਼ਿਆਰ ਬਣੇਗਾ ਇਹ ਸਭ ਕੁਛ ਟੀ ਵੀ ਦੇ ਰਾਹੀਂ ਹੀ ਹੋ ਸਕਦਾ ਹੈ ਜਾਂ ਔਨਲਾਈਨ ਦੇ ਰਾਹੀਂ ਔਨਲਾਈਨ ਹੋ ਸਕਦਾ ਹੈ ਟੀ ਵੀ ਵਿੱਚ ਅੱਜ ਕੱਲ੍ਹ 'ਚ ਕਈ ਐਸੇ ਪੜ੍ਹਨ ਵਾਲੇ ਚੈਨਲ ਹੈ ਜਿਸ ਵਿੱਚ ਅਲੱਗ ਅਲੱਗ ਕਲਾਸਾਂ ਦੇ ਸਿਲੇਬਸ ਬੱਚਿਆਂ ਨੂੰ ਕਵਰ ਕਰਾਇਆ ਜਾਂਦਾ ਹੈ ਅਤੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਜਾ ਸਕਦਾ ਹੈ ਇੱਦਾਂ ਹੀ ਅੱਜ ਕੱਲ੍ਹ ਕਈ ਟੀਚਰਾਂ ਨੇ ਇੱਕ ਨਵਾਂ ਬਿਜ਼ਨਸ ਸ਼ੁਰੂ ਕਰ ਦਿੱਤਾ ਹੈ ਜਿਸ ਵਿੱਚ ਉਹ ਆਪਣੀ ਕਲਾਸਾਂ ਯੂਟਿਊਬ ਦੇ ਰਾਹੀਂ ਦਿੰਦੇ ਹਨ ਅਤੇ ਬੱਚਿਆਂ ਨੂੰ ਸਿਖਾਉਂਦੇ ਹਨ ਇਹ ਇਸਦੇ ਰਾਹੀਂ ਇੱਕ ਤਾਂ ਉਹ ਪੈਸੇ ਵੀ ਕਮਾ ਰਹੇ ਹਨ ਅਤੇ ਬੱਚਿਆਂ ਨੂੰ ਵੀ ਪੜ੍ਹਾ ਰਹੇ ਹਨ ਜੋ ਬੱਚੇ ਸਕੂਲ ਅਫੋਰਡ ਨਹੀਂ ਕਰ ਪਾਉਂਦੇ ਉਹ ਔਨਲਾਈਨ ਪੜ੍ਹਦੇ ਹਨ ਕਿਉਂਕਿ ਉਸਦੀ ਕੀਮਤ ਸਕੂਲਾਂ ਨਾਲੋਂ ਘੱਟ ਹੈ ਅਤੇ ਖਰਚਾ ਵੀ ਉਸ 'ਤੇ ਘੱਟ ਹੀ ਆਉਂਦਾ ਹੈ ਘਰ ਘਰ ਬੈਠ ਕੇ ਹੀ ਬੱਚੇ ਪੜ੍ਹ ਲਿਖਦੇ ਹਨ